ਅੱਜ ਕੱਲ੍ਹ ਦੇ ਜਮਾਨੇ ਵਿੱਚ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਦੇ ਕੋਲ ਹੈਡਫ਼ੋਨਸ ਦਿਖਾਈ ਦਿੰਦੇ ਹਨ ਇਹਨਾਂ ਨੂੰ ਇਨ੍ਹਾਂ ਦਾ ਲਾਭ ਅਤੇ ਲਾਭ ਤਾਂ ਕੁਝ ਕੁ ਹੀ ਮਿਲਦੇ ਹਨ ਪਰ ਹਾਨੀਆਂ ਬਹੁਤ ਜ਼ਿਆਦਾ ਹਨ ਹਾਨੀਆਂ ਅਤੇ ਹਾਨੀਕਾਰਕ ਹੋਣਾ ਹੋਣ ਦੇ ਬਾਵਜੂਦ ਵੀ ਸਭ ਇਸ ਦੀ ਵਰਤੋਂ ਰੋਜ਼ ਦਿਨ ਪ੍ਰਤੀਦਿਨ ਵੱਧਦੀ ਵੱਧ ਤੋਂ ਵੱਧ ਹੀ ਕਰ ਰਹੇ ਹਨ ਸਭ ਨੂੰ ਪਤਾ ਹੁੰਦਾ ਹੋਏ ਵੀ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਇਸ ਦੀ ਵਰਤੋਂ ਕਰਨ ਤੋਂ ਨਹੀਂ ਹੱਟ ਰਹੇ ਹਨ ਇਸ ਦੀ ਵਰਤੋਂ ਕਰਨ ਨਾਲ਼ ਕੰਨ ਦੇ ਪਰਦੇ ਅਤੇ ਕੰਨਾਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਵੀ ਹੋ ਰਹੀਆਂ ਹਨ ਅਤੇ ਦਿਮਾਗੀ ਤੌਰ 'ਤੇ ਵੀ ਬੱਚਾ ਵੱਡਾ ਬਜ਼ੁਰਗ ਬਹੁਤ ਜ਼ਿਆਦਾ ਅੱਪਸੈਟ ਹੋ ਜਾਂਦੇ ਹਨ ਇਸ ਦੇ ਨਾਲ਼ ਹੀ ਬਹੁਤ ਜ਼ਿਆਦਾ ਬਿਮਾਰੀਆਂ ਹੋ ਰਹੀਆਂ ਹਨ ਅਤੇ ਬੱਚਿਆਂ ਦੀਆਂ ਜਾਨਾਂ ਵੀ ਜਾ ਰਹੀਆਂ ਹਨ ਇਸ ਹੈਡਫੋਨ ਨਾ ਲਾਉਣ ਦੇ ਲਈ ਸਭ ਨੂੰ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ